ਮੋਹਾਲੀ ਵਿੱਚ ਘੁੰਮਣ ਫਿਰਨ ਦੀਆਂ ਜਗ੍ਹਾਵਾਂ ਅਤੇ ਇਤਿਹਾਸਿਕ ਜਗ੍ਹਾਵਾਂ ਗੁਰਦੁਆਰਾ ਸਿੰਘ ਸ਼ਹੀਦਾਂ ਅੰਬ ਸਾਹਿਬ ਮਾਤਾ ਸ਼ੀਤਲਾ ਮੰਦਰ ਅਤੇ ਚੱਪੜ ਚਿੜੀ ਫਤਿਹ ਬੁਰਜ ਆਪਾਂ ਕਦੇ ਵੀ ਜਾ ਸਕਦੇ ਹਾਂ ਕਿਸੇ ਵੀ ਟਾਈਮ ਮੱਥਾ ਟੇਕਣ ਜਾ ਸਕਦੇ ਹਾਂ ਅਤੇ ਆਪਣਾ ਸਮਾਂ ਬਿਤਾਉਣ ਦੇ ਲਈ ਸਾਡੇ ਕੋਲ ਸਿਸਵਾਂ ਡੈਮ ਹੈਗਾ ਚਿੜੀਆਂ ਘਰ ਛੱਤਬੀੜ ਪਾਰਕ ਹੈਗੇ ਹੈ ਸਾਡੇ ਕੋਲ ਬਹੁਤ ਸਾਰੇ ਇਹਨਾਂ ਵਿੱਚ ਅਸੀਂ ਵਧੀਆ ਸਮਾਂ ਆਪਣਾ ਕਦੇ ਵੀ ਬਿਤਾ ਸਕਦੇ ਹਾਂ ਅਤੇ ਖਾਣ ਪੀਣ ਲਈ ਬਹੁਤ ਵਧੀਆ ਰੈਸਟੋਰੈਂਟ ਬਥੇਰੇ ਹੈਗੇ ਜਾ ਸਕਦੇ ਹਾਂ ਜਿਵੇਂ ਚੰਡੀਗੜ੍ਹ ਵਿੱਚ ਹੈਗੇ ਨੇੜੇ ਸਾਡੇ ਰੈਸਟੋਰੈਂਟ ਹੈਗੇ ਹੈ ਖਾਣ ਪੀਣ ਲਈ ਉਨ੍ਹਾਂ ਵਿੱਚ ਅਸੀਂ ਜਾ ਸਕਦੇ ਹਾਂ